ਹਾਂਜੀ ਬਿਲਕੁਲ ਪਿਛਲੇ ਸਾਲ ਮੈਂ ਇੱਕ ਜੌਗਰਫੀ ਦੀ ਕਿਤਾਬ ਜਿਹਦਾ ਨਾਮ ਸੀ ਫਿਜ਼ਿਕਲ ਜੌਗਰਫੀ ਜਿਉਮਰਫੋਲੋਜੀ ਬਾਏ ਸਵਿੰਦਰਾ ਸਿੰਘ ਜਿਹਨਾਂ ਦੀ ਇਹ ਕਿਤਾਬ ਇੰਗਲਿਸ਼ ਮੀਡੀਅਮ ਦੇ ਵਿੱਚ ਲਿਖੀ ਹੋਈ ਸੀ ਸੋ ਉਹਨਾਂ ਦਾ ਮੈਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀਗਾ ਸੋ ਇਹ ਕਿਤਾਬ ਜੋ ਸੀਗੀ ਬੇਸਿਕਲੀ ਜੌਗਰਫਰਸ ਲਈ ਸੀਗੀ ਜਿਸ ਵਿੱਚ ਧਰਤੀ ਨਾਲ ਰਿਲੇਟਿਡ ਜਿੰਨੀਆਂ ਵੀ ਜੌਗਰਫੀ ਦੀਆਂ ਗਤੀਵਿਧੀਆਂ ਸਨ ਉਹਨਾਂ ਬਾਰੇ ਦੱਸਿਆ ਗਿਆ ਸੀਗਾ ਜਿਵੇਂ ਕਿ ਧਰਤੀ ਦਾ ਜਨਮ ਕਿਵੇਂ ਹੋਇਆ ਉਹਦੀ ਉਤਪੱਤੀ ਕਿਵੇਂ ਹੋਈ ਕਿਹੜੀਆਂ ਕਿਹੜੀਆਂ ਥਿਊਰੀਜ਼ ਦਿੱਤੀਆਂ ਗਈਆਂ ਧਰਤੀ ਦੇ ਜਨਮ ਲਈ ਧਰਤੀ ਦੇ ਅੰਦਰੂਨੀ ਢਾਂਚਾ ਕਿਵੇਂ ਦਾ ਹੈ ਧਰਤੀ ਦੇ ਉੱਪਰ ਜਵਾਲਾਮੁਖੀ ਕਿਵੇਂ ਫੱਟਦੇ ਹਨ ਭੂਚਾਲ ਕਿਵੇਂ ਆਉਂਦੇ ਹਨ ਸੋ ਇਹ ਸਾਰੀਆਂ ਜੋ ਐਕਟੀਵੀਟੀਜ਼ ਸਨ ਇਹ ਇੱਕ ਕਿਤਾਬ 'ਚ ਇੰਗਲਿਸ਼ ਦੇ ਵਿੱਚ ਛਪੀ ਹੋਈ ਸੀ ਜਿਹਦਾ ਮੈਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀਗਾ ਸੋ ਜਦੋਂ ਮੈਂ ਇਹ ਅਨੁਵਾਦ ਕਰਨਾ ਸ਼ੁਰੂ ਕੀਤਾ ਸੀਗਾ ਉਸ ਸਮੇਂ ਮੈਨੂੰ ਬਹੁਤ ਸਾਰੀਆਂ ਦਿੱਕਤਾਂ ਆਈਆਂ ਜਿਵੇਂ ਕਿ ਕਾਫੀ ਸਾਰੇ ਇੰਗਲਿਸ਼ ਦੇ ਐਵੇਂ ਦੇ ਸ਼ਬਦ ਸੀਗੇ ਜਿਹਨਾਂ ਦੇ ਮੈਨੂੰ ਪੰਜਾਬੀ ਮਤਲਬ ਨਹੀਂ ਸੀ ਪਤਾ ਸੋ ਜਿਹਨਾਂ ਨੂੰ ਮੈਂ ਗੂਗਲ ਟਰਾਂਸਲੇਟ ਕਰਕੇ ਅਤੇ ਡਿਕਸ਼ਨਰੀ ਦੇ ਵਿੱਚੋਂ ਓਹਨਾਂ ਦੇ ਉਚਿਤ ਜੋ ਸ਼ਬਦ ਸਨ ਪੰਜਾਬੀ ਦੇ ਵਿੱਚ ਪਹਿਲਾਂ ਉਹਨਾਂ ਨੂੰ ਲੱਭਿਆ ਫਿਰ ਉਸ ਤੋਂ ਬਾਅਦ ਇਸ ਸਾਰੀ ਕਿਤਾਬ ਨੂੰ ਮੈਂ ਹੱਥ ਦੇ ਨਾਲ ਲਿਖਿਆ ਪੰਜਾਬੀ ਦੇ ਵਿੱਚ ਅਤੇ ਉਸ ਤੋਂ ਬਾਅਦ ਇਹਦੀ ਪਰੂਫਰੀਡਿੰਗ ਕੀਤੀ ਅਤੇ ਜਿਸ ਤੋਂ ਬਾਅਦ ਮੈਂ ਇਸ ਕਿਤਾਬ ਦੀ ਟਾਇਪਿੰਗ ਵੀ ਖੁਦ ਕੀਤੀ ਸੀ ਤਾਂ ਕਿ ਕੋਈ ਗਲਤੀ ਨਾ ਰਹਿ ਜਾਵੇ ਜੋ ਕਿ ਜਿ ਜੋ ਕਿਉਂਕਿ ਇਹ ਕਿਤਾਬ ਜੋ ਹੈ ਉਹ ਜੌਗਰਫੀ ਦੇ ਸਟੂਡੈਂਟਸ ਜੋ ਕਿ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦੋਨੋ ਹੀ ਕਲਾਸਿਸ ਵਿੱਚ ਪੜ੍ਹਦੇ ਹਨ ਉਹਨਾਂ ਲਈ ਕਾਫੀ ਜ਼ਿਆਦਾ ਫਾਏਦੇਮੰਦ ਹੈ ਸੋ ਇਸ ਲਈ ਮੈਂ ਇਹਦੀ ਟਾਇਪਿੰਗ ਖੁਦ ਕੀਤੀ ਸੀਗੀ ਸੋ ਟਾਇਪਿੰਗ ਕਰਦੇ ਦੌਰਾਨ ਮੈਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਬਟ ਐਟ ਦਾ ਐਂਡ ਜਦੋਂ ਇਹ ਕਿਤਾਬ ਪਬਲਿਸ਼ ਹੋ ਕੇ ਆਈ ਅਤੇ ਇਸ ਕਿਤਾਬ ਨੂੰ ਕਾਫੀ ਜ਼ਿਆਦਾ ਹਰਮਨ ਪਿਆਰਤਾ ਮਿਲੀ ਅਤੇ ਇਹਦੇ ਅ ਨਿਅਰ ਅਬਾਊਟ ਪੰਜ ਸੋ ਅਡੀਸ਼ਨਸ ਹੱਥੋਂ ਹੱਥ ਵਿਕ ਗਏ ਤਾਂ ਉਸ ਤੋਂ ਬਾਅਦ ਮੈਨੂੰ ਹੋਰ ਵੀ ਜ਼ਿਆਦਾ ਪ੍ਰੋਤਸਾਹਨ ਮਿਲਿਆ ਕਿ ਮੈਂ ਹੋਰ ਵੀ ਕਿਤਾਬਾਂ ਜੋ ਹਨ ਜੋ ਅੰਗਰੇਜੀ ਮੀਡੀਅਮ ਦੇ ਵਿੱਚ ਲਿਖੀਆਂ ਹੋਈਆਂ ਹਨ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਾਂ ਤਾਂ ਕਿ ਜੋ ਸਾਡੇ ਪੰਜਾਬ ਦੇ ਬੱਚੇ ਹਨ ਉਹਨਾਂ ਨੂੰ ਕੀ ਹੈ ਪੜ੍ਹਨ ਦੇ ਵਿੱਚ ਆਸਾਨੀ ਹੋਵੇ ਅਤੇ ਇਸ ਦੇ ਨਾਲ ਹੀ ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਵੀ ਪ੍ਰਮੋਟ ਕਰ ਸਕੀਏ ਜਿਸ ਦੇ ਨਾਲ ਕੀ ਹੈ ਜੋ ਸਾਡੀਆਂ ਖ਼ਤਮ ਹੋ ਰਹੀਆਂ ਭਾਸ਼ਾਵਾਂ ਹਨ ਜੋ ਕਿ ਪੰਜਾਬੀ ਹੋ ਗਈ ਹੈ ਹੋਰ ਵੀ ਸਾਡੀਆਂ ਲੋਕਲ ਭਾਸ਼ਾਵਾਂ ਹਨ ਉਹਨਾਂ ਨੂੰ ਅਸੀਂ ਹੋਰ ਵੀ ਜ਼ਿਆਦਾ ਕੀ ਹੈ ਹਰਮਨ ਪਿਆਰਤਾ ਦਿਲਵਾ ਸਕੀਏ